ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਗੱਲ ਕਰ ਰਿਹਾ ਹਾਂ ਸਾਡੇ ਸਾਡੇ ਖੇਤਰ ਵਿੱਚ ਮਸ਼ਹੂਰ ਸਿਨੇਮਾ ਥੀਏਟਰ ਜਿਹੜੇ ਕਿ ਜਿਹੜੇ ਹਨ ਜਿਵੇਂ ਵੈਸੇ ਤਾਂ ਪਠਾਨਕੋਟ ਜ਼ਿਲ੍ਹੇ ਵਿੱਚ ਕਾਫ਼ੀ ਥੀਏਟਰ ਹਨ ਪਰ ਜੇ ਮੈਂ ਮਸ਼ਹੂਰ ਸਿਨੇਮਾ ਥੀਏਟਰ ਦੀ ਗੱਲ ਕਰਾਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹੁਣ ਪੀ ਵੀ ਆਰ ਥਿਏਟਰ ਹੈ ਨਵੀ ਨੇਵੀ ਨੇਵੀ ਗਿੱਟ ਮੋਲ ਦੇ ਲਾਗੇ ਲਾਗੇ ਹੈ ਅਤੇ ਇਸ ਦੇ ਵਿੱਚ ਹਰ ਟਾਈਮ ਇੱਕ ਏ ਆਏ ਆਏ ਏ ਦੀਆਂ ਫ਼ਿਲਮਾਂ ਚਲਾਈਆਂ ਜਾਂਦੀਆਂ ਹਨ ਮੈਂ ਪੰਜਾਬੀ ਫ਼ਿਲਮਾਂ ਵੇਖਣਾ ਪਸੰਦ ਕਰਦਾ ਹਾਂ ਅਤੇ ਜੇ ਮੈਂ ਗੱਲ ਕਰਾਂ ਕਿ ਅਸੀਂ ਕਿਸ ਨਾਲ਼ ਜਾਂਦੇ ਹਾਂ ਅਤੇ ਮੈਂ ਜ਼ਿਆਦਾਤਰ ਆਪਣੇ ਪਰਿਵਾਰ ਨਾਲ਼ ਕਦੀ ਕਦੀ ਉੱਥੇ ਫ਼ਿਲਮ ਦੇਖਣ ਜਾਂਦਾ ਹਾਂ ਮੈਂ ਇਸ 'ਚ ਮੈਂ ਗੱਲ ਕਰ ਰਿਹਾ ਹਾਂ ਉਸਦੀ ਟਿਕਟ ਦੀ ਅਤੇ ਇਸ ਸਿਨੇਮਾ ਦੀ ਖਾਸੀਅਤ ਹੈ ਇਹ ਹੈ ਕਿ ਇੱਥੇ ਦੀ ਟਿਕਟ ਉੱਤੇ ਸਾਰਿਆਂ ਨੂੰ ਕਾਫ਼ੀ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ ਅਤੇ ਇਸ ਟਿਕਟ ਦੇ ਅੰਦਰ ਹੀ ਤੁਸੀਂ ਖਾਣ ਵਾਲੀਆਂ ਚੀਜ਼ਾਂ ਵੀ ਅਨੰਦ ਲੈ ਸਕਦੇ ਹੋ ਇੱਥੇ ਥਿਏਟਰ ਦੇ ਅੰਦਰ ਚਾਰ ਪੰਜ ਸਕਰੀਨਾਂ ਹਨ ਜਿਸ ਉੱਤੇ ਵੱਖ ਵੱਖ ਫ਼ਿਲਮਾਂ ਚਲਾਈਆਂ ਜਾਂਦੀਆਂ ਹਨ ਅਤੇ ਇਸ ਇਹ ਸਾਰਾ ਥਿਏਟਰ ਏ ਸੀ ਦੇ ਨਾਲ਼ ਭਰਿਆ ਹੋਇਆ ਹੈ ਇਹ ਹੋਰ ਇਹ ਵਿੱਚ ਇੱਕ ਬਹੁਤ ਵੱਡਾ ਮੋਲ ਵੀ ਹੈ ਜਿੱਥੇ ਅਸੀਂ ਬਹੁਤ ਕੁਝ ਖਰੀਦ ਵੀ ਸਕਦੇ ਹਾਂ ਧੰਨਵਾਦ